ਪੰਜਾਬ ਦਾ ਸੱਭਿਆਚਾਰਕ ਬਹੁਤ ਅਮੀਰ ਹਨ ਉਹਦਾ ਖਾਣਾ ਪੀਣਾ ਬਹੁਤ ਖੁੱਲ੍ਹਾ ਹੈ ਉਹਦਾ ਘੁੰਮਣਾ ਫਿਰਨਾ ਹਰ ਥਾਂ 'ਤੇ ਪੂਰੇ ਖੁੱਲ੍ਹੇ ਹੋ ਕੇ ਰਹਿਣਾ ਹੱਸਦੇ ਰਹਿਣਾ ਹਮੇਸ਼ਾ ਲੋਕਾਂ ਨੂੰ ਹੱਸਦੇ ਮਿਲਣਾ ਇਹ ਚੀਜ਼ ਸਭ ਤੋਂ ਖਾਸੀਅਤ ਹੈ ਪੰਜਾਬ ਦੀ ਕਿ ਉਹ ਜਿਸ ਕਿਸੇ ਨੂੰ ਵੀ ਮਿਲਦੇ ਹਨ ਉਹ ਉਹਨੂੰ ਆਪਣਾ ਬਣਾ ਕੇ ਰੱਖ ਲੈਂਦੇ ਹਨ